ਹੈਲੋ ਹੈਲੋ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਜੀ ਬੀਨ ਵੈਜੀਟੇਬਲ ਬਰਨਾਲਾ ਤੋਂ ਬੋਲਦੇ ਹੋ ਜੀ ਜੀ ਸਾਡੇ ਹੈ ਨਾ ਮੈਰਿਜ ਹੈਗੀ ਮਤਲਬ ਦੋ ਤਿੰਨ ਪ੍ਰੋਗਰਾਮ ਇਕੱਠੇ ਨੇਗੇ ਅਸੀਂ ਸਬਜ਼ੀਆਂ ਲੈਣੀਆਂ ਸੀਗੀਆਂ ਵੀ ਤੁਹਾਡੇ ਸ਼ੋਪ 'ਤੇ ਕਿੱਦਾਂ ਸਬਜ਼ੀ ਵਧੀਆ ਮਿਲਦੀ ਹੈ ਜੀ ਅੱਛਾ ਜੀ ਅੱਛਾ ਜੀ ਵੈਸੇ ਕੀ ਕੀ ਸਬਜ਼ੀ ਕੀ ਕੀ ਸਬਜ਼ੀ ਹੈ ਜੀ ਅੱਛਾ ਜੀ ਅੱਛਾ ਸਾਡੇ ਵੀ ਇੱਥੇ ਮੈਰਿਜ ਸਾਡੇ ਮੈਰਿਜ ਸੀਗੀ ਉਹ ਲੈ ਕੇ ਗਏ ਸੀ ਸਾਨੂੰ ਵਧੀਆ ਲੱਗੀਆਂ ਸਬਜ਼ੀਆਂ ਅਤੇ ਉਹਨਾਂ ਤੋਂ ਹੀ ਨੰਬਰ ਲਿੱਤਾ ਸੀਗਾ ਅਸੀਂ ਇਸ ਕਰਕੇ ਤਾਂ ਹੀ ਤੁਹਾਨੂੰ ਕੌਲ ਕੀਤਾ ਗਾ ਉਹ ਮਤਲਬ ਕਿ ਸਾਡੇ ਦੋ ਤਿੰਨ ਪ੍ਰੋਗਰਾਮ ਨੇਗੇ ਉਹਨਾਂ ਵਾਸਤੇ ਚਾਹੀਦੇ ਸਾਨੂੰ ਆਲੂ ਪਿਆਜ਼ ਮਟਰ ਟਮਾਟਰ ਆ ਅਤੇ ਸ਼ਿਮਲਾ ਮਿਰਚ ਇੱਦਾਂ ਦਾ ਸਾਰਾ ਸਬਜ਼ੀਆਂ ਟਾਈਮ ਅੱਛਾ ਅੱਛਾ ਜੀ ਤੁਹਾਡੀ ਵਿ ਵੈਸੇ ਸ਼ੌਪ ਕਿੱਥੇ ਹੈ ਜੀ ਤੁਹਾਡੀ

ਅੱਛਾ ਜੀ ਹਾਂਜੀ ਕਿੰਨੇ ਵਜੇ ਤੱਕ ਅਸੀਂ ਆ ਸਕਦੇ ਤੁਹਾਡੇ ਮਤਲਬ ਕਿ ਕਿੰਨੇ ਵਜੇ ਅੱਛਾ ਜੀ ਵਧੀਆ ਹੁੰਦੀਆਂ ਨੇ ਸਾਰੇ ਸਾਨੂੰ ਜੀ ਪਰਸੋਂ ਤੱਕ ਚਾਹੀਦੀਆਂ ਨੇਗੀਆਂ ਹਾਂਜੀ ਵੈਸੇ ਪਹਿਲਾਂ ਕੋਈ ਨਾ ਜੀ ਅਸੀਂ ਪਰਸੋਂ ਤੱਕ ਆਵਾਂਗੇ ਸ਼ਾਇਦ ਅਸੀਂ ਕੱਲ ਨੂੰ ਵੀ ਆ ਸਕਦੇ ਐਂਗੇ ਕੁਛ ਸਬਜ਼ੀਆਂ ਕੱਲ ਨੂੰ ਲੈ ਜਾਵਾਂਗੇ ਅਤੇ ਮਤਲਬ ਹਾਂਜੀ ਕੇ ਹਾਂਜੀ ਕੇ ਸੀ ਰੋਡ ਗਲੀ ਨੰਬਰ ਸੱਤ 'ਚ ਠੀਕ ਹੈ ਜੀ ਕੋਈ ਨਾ ਜੀ ਠੀਕ ਹੈ ਜੀ ਓਕੇ ਜੀ ਵੈਲਕਮ ਜੀ